ਹੈਲੋ ਨਮਸਕਾਰ ਸਾਰੇ ਭੈਣ ਭਰਾਵਾਂ ਨੂੰ ਇੱਥੇ ਇਕੱਠੇ ਹੋਣ 'ਤੇ ਅੱਜ ਅਸੀਂ ਇੱਥੇ ਰੀਸਾਈਕਲ ਮਤਲਬ ਆਪਣੇ ਆਪ ਸੇ ਮਤਲਬ ਆਪਣੀ ਕਮਿਊਨਿਟੀ ਸਫਾਈ ਅਤੇ ਜਿਹੜੀਆਂ ਚੀਜ਼ਾਂ ਦੁਬਾਰਾ ਰੀਸਾਈਕਲ ਹੋ ਕੇ ਸਾਡੀ ਵਰਤੋਂ ਵਿੱਚ ਆਉਂਦੀਆਂ ਨੇ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਲੈਣ ਲਈ ਮਤਲਬ ਵੀ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਠੀਕ ਹੈ ਫਸਟ ਆਫ ਆਲ ਅਸੀਂ ਜੇ ਆਪਣੀ ਕਮਿਊਨਿਟੀ ਅਸੀਂ ਆਪਣੇ ਆਸ ਪਾਸ ਦੀ ਸਫਾਈ ਕਰਨ ਦੇ ਬਾਰੇ ਸੋਚ ਰਹੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਅਸੀਂ ਪਲਾਸਟਿਕ ਦੀ ਵਰਤੋਂ ਕਰਦੇ ਉਸ ਚੀਜ਼ ਨੂੰ ਬੰਦ ਕਰਨਾ ਹੋਵੇਗਾ ਅਸੀਂ ਜਿਹੜੀਆਂ ਸਬਜ਼ੀ ਵਗੈਰਾ ਵਾ ਉਹ ਘਰ ਵਿੱਚੋਂ ਜਿਹੜੇ ਬਣੇ ਹੋਏ ਜਿਹੜੇ ਕੱਪੜੇ ਦੇ ਥੈਲੇ ਆ ਉਹ ਲੈ ਕੇ ਜਾਈਏ ਜਾਂ ਅਸੀਂ ਪੇਪਰ ਮਤਲਬ ਜਿਹੜੇ ਪੋਲੀਥੀਨ ਆ ਜਾਂ ਪੇਪਰ ਦੇ ਪੇਪਰ ਦੇ ਪੇਪਰ ਉਹ ਆ ਲਿਫਾਫੇ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਘਰ ਦੇ ਵਿੱਚ ਰਾਸ਼ਨ ਲਿਆਉਣ ਲਈ ਜਾਂ ਸਬਜ਼ੀ ਲਿਆਉਣ ਵਾਸਤੇ ਜਾਂ ਗੱਤੇ ਦੇ ਡੱਬੇ ਦਾ ਇਸਤੇਮਾਲ ਕੀਤਾ ਜਾ ਸਕੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਪਲਾਸਟਿਕ ਦੀ ਬੋਟਲ ਜਾਂ ਸਾਡੇ ਬੱਚਿਆਂ ਦੇ ਟੀਫਨ ਜਿਹੜੇ ਬੇਕਾਰ ਹੋ ਜਾਂਦੇ ਨੇ ਉਹਨਾਂ ਨੂੰ ਕੂੜੇ ਵਿੱਚ ਸਿੱਟਣ ਦੀ ਬਜਾਏ ਅਸੀਂ ਉਸ ਪਲਾਸਟਿਕ ਵਾਲੇ ਨੂੰ ਉਸ ਜਗ੍ਹਾ 'ਤੇ ਦਈਏ ਜਿੱਥੋਂ ਉਹ ਚੀਜ਼ਾਂ ਰੀਸਾਈਕਲ ਹੋ ਕੇ ਦੁਬਾਰਾ ਸਾਡੀ ਯੂਜ ਵਿੱਚ ਇਸਤੇਮਾਲ ਲਈ ਆ ਜਾਂਦੀਆਂ ਨੇ ਨਾ ਕਿ ਅਸੀਂ ਕੂੜਾ ਕਰਕਟ ਵਿੱਚ ਫੇਂਕੀਏ ਜਿਵੇਂ ਰਿਫਾਇਡ ਆਇਲ ਦੀ ਮਤਲਬ ਮਸਟਰਡ ਆਇਲ ਦੀ ਬੋਟਲ ਜਾਂ ਕਹਿ ਦਿਓ ਕਿ ਸਾਡੇ ਘਰ ਵਿੱਚ ਬਹੁਤ ਸਾਰੀ ਇੱਦਾਂ ਦੀਆਂ ਪਲਾਸਟਿਕ ਦੀਆਂ ਚੀਜ਼ਾਂ ਜਿਹਨਾਂ ਵਿੱਚ ਸਾਡੇ ਕੋਲ ਸਮਾਨ ਆਉਂਦਾ ਜਿਵੇਂ ਪਾਊਡਰ ਆ ਗਿਆ ਆਇਲ ਆ ਗਿਆ ਕੋਈ ਵੀ ਕਰੀਮ ਆ ਗਈ ਕੋਈ ਟੂਥਪੇਸਟ ਵਗੈਰਾ ਦੇ ਉਹ ਆ ਗਏ ਠੀਕ ਹੈ ਉਹ ਪਲਾਸਟਿਕ ਅਸੀਂ ਕੂੜੇ ਦੇ ਵਿੱਚ ਨਾ ਸੁੱਟ ਕੇ ਬਲਕਿ ਉਹ ਅਸੀਂ ਆਪਣੇ ਰੱਦੀ ਵਾਲੇ ਨੂੰ ਜਾਂ ਮਤਲਬ ਜਿਹੜੇ ਕਬਾੜ ਵਾਲੇ ਉਹਨੂੰ ਉਹਦੇ ਤੱਕ ਪਹੁੰਚਾ ਦੇਈਏ ਤਾਂ ਕਿ ਉਥੋਂ ਉਹ ਰਿਸਾਈਕਲ ਲਈ ਭੇਜੀਆ ਜਾਣ ਉਹ ਦੁਬਾਰਾ ਉਹ ਚੀਜ਼ਾਂ ਰੀਸਾਈਕਲ ਹੋ ਕੇ ਸਾਡੇ ਯੂਜ ਦੇ ਲਈ ਆ ਜਾਂਦੀਆਂ ਨੇ ਅਤੇ ਉਹਨਾਂ ਨੂੰ ਕੂੜੇ ਵਿੱਚ ਨਾ ਸੁੱਟਣ ਦੀ ਬਜਾਏ ਅਸੀਂ ਰੀਸਾਈਕਲ ਕੇਂਦਰਾਂ ਤੱਕ ਉਹਨਾਂ ਨੂੰ ਪਹੁੰਚਾਈਏ ਤਾਂ ਕਿ ਉਹ ਕੂੜੇ ਵਿੱਚ ਕਿਉਂਕਿ ਉਹ ਜਿਹੜਾ ਪਲਾਸਟਿਕ ਆ ਜੇ ਉਹ ਅਸੀਂ ਪੂਰੇ ਵਿੱਚ ਸਿੱਟਦੇ ਹਾਂ ਅਤੇ ਉਹਦੇ ਨਾਲ ਕੀ ਹੁੰਦਾ ਕਿ ਪਲਾਸਟਿਕਲ ਗਲਦਾ ਨਹੀਂ ਹੈ ਉਹ ਨਾਲ ਸਾਡਾ ਵਾਤਾਵਰਨ ਸਾਡਾ ਆਸ ਪਾਸ ਦਾ ਵਾਤਾਵਰਨ ਸਾਡਾ ਪਰਿਆਵਰਨ ਦੂਸ਼ਿਤ ਹੁੰਦਾ ਹੈ ਠੀਕ ਹੈ ਉਹਦੇ ਨਾਲ ਸਾਰਿਆਂ ਦੇ ਲਈ ਹਾਮਫੁਲ ਹੁੰਦਾ ਹੈ ਜੇ ਅਸੀਂ ਆਪਣੀ ਪ੍ਰਕ੍ਰਿਤੀ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਪਲਾਸਟਿਕ ਦਾ ਵਰਤੋਂ ਪਹਿਲਾਂ ਤੇ ਬਹੁਤ ਘੱਟ ਕਰਨਾ ਚਾਹੀਦਾ ਪਰ ਫਿਰ ਵੀ ਜੇ ਅਸੀਂ ਕਰ ਰਹੇ ਹਾਂ ਅੱਜ ਦੇ ਟਾਈਮ ਟਾਈਮ ਦੇ ਵਿੱਚ ਤਾਂ ਉਹਨੂੰ ਅਸੀਂ ਕੂੜੇ ਵਿੱਚ ਨਾ ਸੁੱਟ ਕੇ ਅਸੀਂ ਆਪਣੇ ਕਬਾੜ ਵਾਲੇ ਨੂੰ ਦੇਈਏ ਥੈਂਕ ਯੂ